ਕਿਤਾਬਾਂ ਜੋ ਕਿ ਰੂਹ ਦੀਆਂ ਖੁਰਾਕ ਹੁੰਦੀ ਹੈ ਕਿਤਾਬਾਂ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਉਸ ਉਹਨਾਂ ਦੀ ਜ਼ਿੰਦਗੀ ਬਹੁਤ ਖੂਬਸੂਰਤ ਹੁੰਦੀ ਹੈ ਕਿਉਂਕਿ ਕਿਤਾਬਾਂ ਸਿਰਫ ਪੜਨ ਵਾਸਤੇ ਨਹੀਂ ਹੁੰਦੀਆਂ ਕਿਤਾਬਾਂ ਸਮਝਣ ਵਾਸਤੇ ਵੀ ਹੁੰਦੀਆਂ ਸਾਨੂੰ ਯਾਦ ਹੈ ਵੀ ਜਦੋਂ ਅਸੀਂ ਅੱਠਵੀਂ ਤੋਂ ਬਾਅਦ ਦਸਵੀਂ ਤੱਕ ਆਏ ਪੜ੍ਹਦੇ ਪੜ੍ਹਦੇ ਤਾਂ ਸਾਡੇ ਸਕੂਲ ਦੇ ਵਿੱਚ ਲਾਇਬਰੇਰੀ ਸੀ ਅੱਧੀ ਛੁੱਟੀ ਦੇ ਵੇਲੇ ਅਸੀਂ ਲਾਇਬ੍ਰੇਰੀ 'ਚ ਜਾਣਾ ਜਾ ਕੇ ਅਖ਼ਬਾਰ ਦੇਖਣੇ ਪੰਜਾਬੀ ਦੇ ਅਖ਼ਬਾਰ ਪੜ੍ਹਨੇ ਖ਼ਬਰਾਂ ਪੜ੍ਹਨੀਆਂ ਅਤੇ ਇੱਕ ਚੱਕਰ ਅੰਦਰੋਂ ਜਦੋਂ ਪੂਰਾ ਲਾਈਬਰੀ ਦਾ ਕ ਘੁੰਮਦੇ ਤਾਂ ਕਿਤਾਬਾਂ ਅਲੱਗ ਅਲੱਗ ਰੈਂਕਾਂ ਦੇ ਵਿੱਚ ਫੁੱਲਾਂ ਵਾਂਗੂੰ ਸਜਾਈਆਂ ਪਈਆ ਹੁੰਦੀਆਂ ਸੀ ਪਲਸ ਟੂ ਤੋਂ ਬਾਅਦ ਅਖ਼ਬਾਰ ਪੜ੍ਹਦੇ ਪੜ੍ਹਦੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਜਾਗਿਆ ਜਦੋਂ ਬੀ ਏ ਤੱਕ ਆਏ ਤਾਂ ਪੰਜਾਬੀ ਸਾਹਿਤ ਨਾਲ ਜੁੜੇ ਸਰਕਾਰੀ ਕਾਲਜ ਦੇ ਵਿੱਚ ਸਾਡੇ ਇੱਕ ਲਾਇਬਰੇਰੀ ਹੁੰਦੀ ਸੀ ਉਸ ਲਾਇਬਰੇਰੀ ਦੇ ਵਿੱਚ ਜਦੋਂ ਅਸੀਂ ਜਾਣਾ ਤਾਂ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਕਿਹੜੀਆਂ ਕਿਹੜੀਆਂ ਲਾਈਬ੍ਰੇਰੀ 'ਚ ਪਈਆਂ ਹੋਣ ਉਹਦੀ ਸੂਚੀ ਦੇਖਣੀ ਮੈਨੂੰ ਯਾਦ ਹੈ ਨਰਿੰਦਰ ਸਿੰਘ ਕਪੂਰ ਜੋ ਕਿ ਪੰਜਾਬ ਦੇ ਉੱਗੇ ਲੇਖਕ ਨੇ ਪਟਿਆਲਾ 'ਚ ਰਹਿੰਦੇ ਨੇ ਮੈਂ ਉਹਨਾਂ ਦੀ ਕਿਤਾਬ ਸਭ ਤੋਂ ਪਹਿਲਾਂ ਪੜ੍ਹੀ ਸੀ ਮਾਲਾ ਮਣਕੇ ਮਾਲਾ ਮਣਕੇ ਕਿਤਾਬ ਪੜ੍ਹ ਕੇ ਇੰਨਾ ਸਕੂਨ ਮਿਲਿਆ ਜਿੰਦਗੀ ਦੀਆਂ ਯਥਾਰਥਕ ਗੱਲਾਂ ਜ਼ਿੰਦਗੀ ਦੀਆਂ ਸੱਚਾਈਆਂ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਲਿਖੀਆਂ ਇੱਕ ਕਿਤਾਬ ਵੀ ਨਹੀਂ ਉਹਨਾਂ ਦੀ ਮਾਲਾ ਮਣਕੇ ਖਿੜਕੀਆਂ ਖਿੜਕੀਆਂ ਟੂ ਰਾਹ ਰਸਤੇ ਦਰ ਦਰਵਾਜ਼ੇ ਉਹਨਾਂ ਨੇ ਇਹਨਾਂ ਆਪਣੀਆਂ ਕਿਤਾਬਾਂ ਦੇ ਵਿੱਚ ਇੱਕ ਬੱਚੇ ਦੀ ਮਾਨਸਿਕਤਾ ਤੋਂ ਲੈ ਕੇ ਇੱਕ ਬਜ਼ੁਰਗ ਉਮਰ ਤੱਕ ਕਿੱਦਾਂ ਸਮਾਜਿਕ ਰਿਸ਼ਤੇ ਤਾਣੇ ਬਣੇ ਬੰਦੇ ਦਾ ਵਿਵਹਾਰ ਕਿੱਦਾਂ ਦਾ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੀ ਇੱਛਾਵਾਂ ਕਿਵੇਂ ਪੂਰੀਆਂ ਕਰ ਸਕਦੇ ਹਾਂ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਅਨਮੋਲ ਗੱਲਾਂ ਕਹੀਆਂ ਇਹਨਾਂ ਤੋਂ ਇਲਾਵਾ ਸਰਦਾਰ ਗੁਰਦਿਆਲ ਸਿੰਘ ਮੈਨੂੰ ਯਾਦ ਹੈ ਕਵਿਤਾ ਹੁੰਦੀ ਸੀ ਮੜੀ ਦਾ ਦੀਵਾ ਮੜੀ ਦਾ ਦੀਵਾ ਬਹੁਤ ਸੋਹਣੀ ਕਵਿਤਾ ਅੱਜ ਵੀ ਕਈ ਵਾਰ ਯਾਦ ਆ ਜਾਂਦੀ ਉਹਨਾਂ ਦੀ ਹਰਪਾਲ ਸਿੰਘ ਪੰਨੂ ਪੰਜਾਬ ਦੇ ਉੱਘੇ ਲੇਖਕ ਉਹਨਾਂ ਦੀ ਵੀ ਕਿਤਾਬ ਮੈਂ ਪੜ੍ਹੀ ਸੀ ਗੌਤਮ ਤੋਂ ਤਾਸਕੀ ਤੱਕ ਉਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮੁਹੰਮਦ ਸਾਹਿਬ ਬਾਰੇ ਮਹਾਤਮਾ ਬੁੱਧ ਬਾਰੇ ਬਹੁਤ ਸਬੱਬੀ ਰੂਹਾਂ ਬਾਰੇ ਜਾਣਕਾਰੀ ਦਿਤੀ ਸੀ ਤਾਂ ਅੱਜ ਅਸੀਂ ਟੁੱਟਦੇ ਜਾ ਰਹੇ ਹਾਂ ਕਿਤਾਬਾਂ ਤੋਂ ਕਿਉਂਕਿ ਸਾਰਾ ਕੁਝ ਸਾਨੂੰ ਡਿਜੀਟਲ ਮਿਲ ਗਿਆ ਸ ਪੀ ਡੀ ਐਫ ਮਿਲ ਗਈ ਤੋ ਕਿਤਾਬਾਂ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਅਣਮੁੱਲਾ ਖਜ਼ਾਨਾ ਨੇ ਕਿਤਾਬਾਂ ਸਾਨੂੰ ਧਿਆਨ ਲਾਉਣਾ ਸਿਖਾਉਂਦੇ ਕਿ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ ਤੁਹਾਡਾ ਧਿਆਨ ਕਿਤੇ ਨਹੀਂ ਭਟਕਦਾ ਤਾਂ ਇਸ ਕਰਕੇ ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਕਿਤਾਬਾਂ ਨਾਲ ਸਾਨੂੰ ਜੁੜੇ ਰਹਿਣਾ ਚਾਹੀਦਾ ਹੈ